ਹੈਲੋ ਹਾਂਜੀ ਮੇਰੀ ਸੰਜੇ ਸਰ ਨਾਲ਼ ਗੱਲ ਹੋ ਰਹੀ ਹੈ ਠੀਕ ਹੈ ਸਰ ਮੈਂ ਨਾ ਗੁਜਰਾਤ ਤੋਂ ਆਈ ਸੀ ਇੱਥੇ ਅੰਮ੍ਰਿਤਸਰ ਘੁੰਮਣ ਅਤੇ ਮੈਂ ਨਾ ਇੱਥੇ ਮਹਾਰਾਜਾ ਰਣਜੀਤ ਸਿੰਘ ਬਾਰੇ ਬਹੁਤ ਸੁਣਿਆ ਹੋਇਆ ਤੁਸੀਂ ਉਹਦੇ ਬਾਰੇ ਮੈਨੂੰ ਦੱਸ ਸਕਦੇ ਹੋ ਨਾਲ਼ੇ ਇੱਥੇ ਕਿੱਥੇ ਉਹਨਾਂ ਦੇ ਕੁਛ ਜਗ੍ਹਾ ਮਿਲ ਸਕਦੀ ਦੇਖਣ ਲਈ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਠੀਕ ਹੈ ਹਾਂਜੀ ਹਾਂਜੀ ਨਹੀਂ ਜ਼ਰੂਰ ਦੇਖ ਕੇ ਜਾਵਾਂਗੇ ਮੈਨੂੰ ਬਹੁਤ ਪਸੰਦ ਹੈ ਹਾਂਜੀ ਹਾਂ ਅੱਛਿਆ

ਠੀਕ ਹੈ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸੋ ਮੱਚ